ਬਾਗਬਾਨੀ ਸੰਦਾਂ ਦੀ ਵਰਤੋਂ ਕਹੀ ਕਸੀਆ ਖੁਰਪੀ ਰੰਬੀ ਸਾਡੇ ਵੀ ਇੱਕ ਬਾਗ ਬਹੁਤ ਸੋਹਣਾ ਬਣਾਇਆ ਘਰ ਘਾਹ ਵੀ ਲਾਇਆ ਫੁੱਲ ਬੂਟੇ ਵੀ ਲਾਏ ਹੋਏ ਆ ਫੁੱਲਾਂ ਬੂਟਿਆਂ ਦੀ ਕਟਾਈ ਵਾਸਤੇ ਕੈਂਚੀ ਵੀ ਵਰਤਦੇ ਹਾਂ ਜਿਹੜਾ ਘਾਹ ਲਾਇਆ ਉਹਦੇ ਵਾਸਤੇ ਇੱਕ ਮਸ਼ੀਨ ਵੀ ਵਰਤਦੇ ਹਾਂ ਮੈਂ ਵੀ ਰੋਜ਼ਾਨਾ ਸਾਡੇ ਘਾਹ ਲਾਇਆ ਉਹਦੀ ਕਟਾਈ ਕਰਦਾ ਅਤੇ ਜਿਹੜੇ ਬਾਗ ਲਾਏ ਹੋਏ ਜਾਂ ਫੁੱਲ ਬੂਟੇ ਲਾਏ ਨੇ ਉਹਨਾਂ ਕਿਆਰੀਆਂ ਦੇ ਵਿੱਚੋਂ ਕੱਖ ਵੀ ਕੱਢਦੇ ਉਹਦੇ ਵਾਸਤੇ ਕਹੀ ਰੰਬੀ ਵਰਤਦੇ ਆ ਮੈਨੂੰ ਬਹੁਤ ਸ਼ੌਕੀਨ ਆ ਫੁੱਲ ਬੂਟੇ ਸੰਭਾਲਣ ਦਾ ਘਾਹ ਸੰਭਾਲਣ ਦਾ ਮੈਂ ਬਹੁਤ ਸ਼ੋਕੀਨ ਹਾਂ ਬਾਕੀ ਵੀ ਜਿਹੜੇ ਘਰੇਲੂ ਕੰਮ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਵਰਤੋਂ ਆ ਉਹ ਕਰਦੇ ਹਾਂ ਮੈਨੂੰ ਵੀ ਫੁੱਲ ਬੂਟੇ ਲਾਉਣ ਦਾ ਅਤੇ ਉਹਨਾਂ ਦੀ ਪਾਲਣ ਪੋਸ਼ਣ ਕਰਨ ਦਾ ਬਹੁਤ ਸ਼ੌਕੀਨ ਆ ਬਹੁਤ ਸਾਡੇ ਘਰੇ ਫੁੱਲਾਂ ਬੂਟਿਆਂ ਦੇ ਪੌਦੇ ਲਾਏ ਆ ਅਤੇ ਦਰੱਖਤ ਵੀ ਬਹੁਤ ਲਾਏ ਆ ਫੁੱਲਾਂ ਦੇ ਬਹੁਤ ਸੋਹਣੇ ਬੂਟੇ ਲਾਏ ਹੋਏ ਆ ਧੰਨਵਾਦ